ਜੀ ਬਿਲਕੁਲ ਮੈਨੂੰ ਆਪਣੇ ਸੱਭਿਆਚਾਰ ਤੋਂ ਇਲਾਵਾ ਹੋਰ ਪਕਵਾਨ ਬਣਾਉਣ ਦਾ ਵੀ ਸ਼ੌਂਕ ਹੈ ਜਿਵੇਂ ਕਿ ਮੇਰਾ ਸੱਭਿਆਚਾਰ ਹੈ ਪੰਜਾਬੀ ਮੈਂ ਪੈਦਾ ਅੰਮ੍ਰਿਤਸਰ ਵਿੱਚ ਹੋਈ ਹਾਂ ਅਤੇ ਇੱਥੋਂ ਦਾ ਖਾਣ ਪਾਣ ਵੀ ਬਚਪਨ ਤੋਂ ਲੈ ਕੇ ਅੱਜ ਤੱਕ ਖਾਂਦੀ ਆਈ ਹਾਂ ਮਗਰ ਮੈਨੂੰ ਚਾਈਨੀਜ਼ ਅਤੇ ਇਟੈਲੀਅਨ ਬਣਾਉਣ ਦਾ ਸ਼ੌਂਕ ਹੈ ਚਾਈਨੀਜ਼ ਵਿੱਚ ਜਿਵੇਂ ਕਿ ਨੂਡਲਸ ਚਿਲੀ ਪਨੀਰ ਬਣਾਉਣਾ ਮਨਚੂਰੀਅਨ ਬਣਾਉਣਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਅੱਜ ਕੱਲ੍ਹ ਤਾਂ ਔਨਲਾਈਨ ਵੀ ਜਿਸ ਤਰ੍ਹਾਂ ਐਮਾਜ਼ੋਨ 'ਤੇ ਰਾਈ ਸ਼ੀਟਸ ਸਪਰਿੰਗ ਰੋਲ ਸ਼ੀਟਸ ਮਿਲਣ ਲੱਗ ਪਈਆਂ ਹਨ ਜਿਹਨੇ ਕਿ ਸਾਡੀ ਕੁਕਿੰਗ ਨੂੰ ਹੋਰ ਵੀ ਜ਼ਿਆਦਾ ਆਸਾਨ ਕਰ ਦਿੱਤਾ ਹੈ ਅਤੇ ਨਾਲ ਦੇ ਨਾਲ ਹੀ ਮੈਨੂੰ ਇਟੈਲੀਅਨ ਖਾਣਾ ਬਣਾਉਣਾ ਵੀ ਬਹੁਤ ਵਧੀਆ ਲੱਗਦਾ ਹੈ ਪੀਜ਼ਾ ਜਿਹੜਾ ਕਿ ਸਾਡੇ ਸਾਰਿਆਂ ਨੂੰ ਹੀ ਬਹੁਤ ਪਸੰਦ ਹੁੰਦਾ ਹੈ ਉਹ ਮੈਂ ਬੜੇ ਹੀ ਖੁਸ਼ ਹੋ ਕੇ ਖਾਂਦੀ ਹਾਂ ਪਾਸਤਾ ਪਾਸਤਾ ਵੀ ਬਾਹਰ ਬਣਾਨ ਬਾਹਰੋਂ ਖਾਣ ਨਾਲੋਂ ਚੰਗਾ ਘਰ ਬਣਾਇਆ ਵਧੀਆ ਹੁੰਦਾ ਹੈ ਪਾਸਤਾ ਵੀ ਮੈਦੇ ਦਾ ਨਹੀਂ ਹੁੰਦਾ ਬਲਕਿ ਸੂਜੀ ਦਾ ਹੁੰਦਾ ਹੈ ਅਤੇ ਜੇ ਇਹਦੇ ਵਿੱਚ ਅਸੀਂ ਸਬਜ਼ੀਆਂ ਪਾ ਲਈਏ ਤਾਂ ਇਹ ਹੋਰ ਵੀ ਹੈਲਦੀ ਹੋ ਜਾਂਦਾ ਹੈ ਬਾਹਰ ਦੇ ਚਾਈਨੀਜ਼ ਜਾਂ ਇਟੈਲੀਅਨ ਨਾਲੋਂ ਘਰ ਦਾ ਚਾਈਨੀਜ਼ ਇਟੈਲੀਅਨ ਬਹੁਤ ਹੀ ਵਧੀਆ ਹੈ ਹਾਲਾਂਕਿ ਮੇਰਾ ਆਪਣਾ ਪੰਜਾਬੀ ਖਾਣਾ ਵੀ ਬਹੁਤ ਵਧੀਆ ਹੈ ਰਾਜਮਾਂਹ ਕੜ੍ਹੀ ਮੈਨੂੰ ਬਹੁਤ ਪਸੰਦ ਹੈ ਮਾਂਹ ਦੀ ਦਾਲ ਲੱਛਾ ਪਰਾਂਠਾ ਲੱਸੀ ਮੈਨੂੰ ਮੇਰੇ ਮਨ ਨੂੰ ਭਾਉਂਦੇ ਨੇ ਮਗਰ ਮੈਂ ਹੋਰ ਹੋਰ ਨਵੀਆਂ ਨਵੇਂ ਤਰ੍ਹਾਂ ਦੇ ਪਕਵਾਨ ਵੀ ਬਣਾਉਣਾ ਬਹੁਤ ਪਸੰਦ ਕਰਦੀ ਹਾਂ